ਹੈਲੋ ਸਰ ਕੀ ਤੁਸੀਂ ਸ਼੍ਰੀ ਕ੍ਰਿਸ਼ਨਾ ਤੋਂ ਗੱਲ ਕਰ ਰਹੇ ਹੋ ਮੈਂ ਤੁਹਾਡੀ ਦੁਕਾਨ ਤੋਂ ਲੋਰੀਅਲ ਦਾ ਕੰਡੀਸ਼ਨਰ ਖਰੀਦਿਆ ਸੀ ਪਰਸੋਂ ਮੈਂ ਤੁਹਾਡੀ ਦੁਕਾਨ 'ਤੇ ਆਈ ਸੀ ਮੈਂ ਤਾਂ ਤੁਹਾਡੀ ਦੁਕਾਨ 'ਤੇ ਸਰ ਇੱਕ ਆਸ ਲਗਾ ਕੇ ਆਈ ਸੀਗੀ ਵੀ ਤੁਸੀਂ ਬਹੁਤ ਵਧੀਆ ਪ੍ਰੋਡਕਟ ਰੱਖਦੇ ਓਂ ਪਰ ਤੁਸੀਂ ਇਹ ਕੀ ਕੀਤਾ ਸਰ ਮੈਨੂੰ ਤਾਂ ਤੁਹਾਡੇ ਤੋਂ ਬਿਲਕੁਲ ਵੀ ਉਮੀਦ ਨਹੀਂ ਸੀਗੀ ਮੈਂ ਤੁਹਾਡੀ ਦੁਕਾਨ ਤੋਂ ਕੰਡੀਸ਼ਨਰ ਲੈ ਕੇ ਗਈ ਮੈਂ ਜਦੋਂ ਉਸਨੂੰ ਘਰ ਲੈ ਕੇ ਆਈ ਅਤੇ ਮੈਨੇ ਆਤੇ ਸਿਰ ਧੋਤਾ ਤਾਂ ਜਦੋਂ ਉਸਨੂੰ ਲਗਾਇਆ ਤਾਂ ਪਹਿਲੀ ਗੱਲ ਉਸਨੂੰ ਕਿੰਨੇ ਵਾਰੀ ਮੈਂ ਪਾਣੀ ਪਾਇਆ ਸਿਰ ਦੇ ਵਿੱਚ ਪਰ ਉਹ ਤਾਂ ਨਿਕਲਿਆ ਹੀ ਨਹੀਂ ਉੱਪਰੋਂ ਦੀ ਜਦੋਂ ਉਹ ਮੈਂ ਆਪਦੇ ਬਾਲ ਸੁਕਾਏ ਤਾਂ ਮੈਂ ਦੇਖਿਆ ਮੇਰੇ ਤਾਂ ਬਾਲਾਂ ਦੇ ਵਿੱਚ ਐਲਰਜੀ ਹੋ ਗਈ ਉੱਪਰੋਂ ਦੀ ਮੇਰੇ ਸਾਰੇ ਬਾਲਾਂ ਦੇ ਵੀ ਵਿੱਚ ਸਿੱਕਰੀ ਆ ਗਈ ਸਰ ਮੈਂ ਤਾਂ ਇਹ ਉਮੀਦ ਕੀਤੀ ਹੀ ਨਹੀਂ ਸੀ ਲੋਰੀਅਲ ਇੰਨਾਂ ਵਧੀਆ ਬ੍ਰਾਂਡ ਅਤੇ ਤੁਸੀਂ ਉਸਦੇ ਵਿੱਚ ਪਾਣੀ ਪਾ ਪਾ ਕੇ ਉਸਨੂੰ ਕੈਮੀਕਲ ਯੂਜ ਕਰ ਰਹੇ ਹੋ ਉਹਨਾਂ ਦੀ ਤੁਸੀਂ ਰੋਇਲ ਦਾ ਲੋਰੀਅਲ ਦਾ ਨਾਮ ਬਦਨਾਮ ਕਰ ਰਹੇ ਹੋ ਸਰ ਤੁਸੀਂ ਇਹੋ ਜਿਹੇ ਗਲਤ ਅਤੇ ਘਟੀਆ ਪ੍ਰੋਡਕਟ ਦੇ ਰਹੇ ਹੋ ਸਰ ਤੁਸੀਂ ਲੋਕਾਂ ਨੂੰ ਮੈਂ ਤੁਹਾਡੀ ਇਹ ਸਾਰੀ ਗੱਲ ਦੱਸਾਂਗੀ ਆਪਦੇ ਸਾਰੇ ਦੋਸਤ ਮਿੱਤਰਾਂ ਨੂੰ ਅਤੇ ਉਹਨਾਂ ਨੂੰ ਕਹਾਂਗੀ ਵੀ ਤੁਹਾਡੀ ਦੁਕਾਨ 'ਤੇ ਉਹ ਨਾ ਜਾਣ ਇਹ ਚੀਜ਼ ਤੁਸੀਂ ਸਰ ਬਹੁਤ ਜ਼ਿਆਦਾ ਗਲਤ ਕਰ ਰਹੇ ਹੋ ਆਪਦੇ ਗ੍ਰਾਹਕਾਂ ਦੇ ਨਾਲ ਤੁਹਾਡੀ ਦੁਕਾਨ 'ਤੇ ਕੋਈ ਵੀ ਨਹੀਂ ਆਏਗਾ ਅਤੇ ਤੁਹਾਡੀ ਦੁਕਾਨ 'ਤੇ ਤਾਲਾ ਲੱਗ ਜਾਵੇਗਾ ਮੈਂ ਤੁਹਾਡੀ ਇਹ ਕੰਪਲੇਂਟ ਕਰਾਂਗੀ ਤੁਹਾਨੂੰ ਪਤਾ ਹੈ ਮੈਂ ਇੱਕ ਵਕੀਲ ਹਾਂ ਅਤੇ ਮੇਰਾ ਇੱਥੇ ਨਾਮ ਬਹੁਤ ਵਧੀਆ ਚੱਲਦਾ ਹੈ ਓਰੇ ਸੀਟੀ ਤੁਹਾਡੀ ਸਿਟੀ ਦੇ ਵਿੱਚ ਮੈਂ ਤੁਹਾਡੀ ਇੱਕ ਕੰਪਲੇਂਟ ਕਰਾਂਗੀ ਮੈਂ ਤੁਹਾਡੇ ਅਗੇਂਸਟ ਕੰਜਿਊਮਰ ਪ੍ਰੋਟੈਕਸ਼ਨ ਐਕਟ ਦੇ ਅੰਡਰ ਕੇਸ ਕਰਾਂਗੀ ਕਿ ਤੁਸੀਂ ਮੈਨੂੰ ਗਲਤ ਚੀਜ਼ ਭੇ ਵੇਚੀ ਹੈ ਫਿਰ ਇੱਦਾਂ ਨਹੀਂ ਕਰਨਾ ਚਾਹੀਦਾ ਅਗਰ ਕੰਪਨੀ ਨੇ ਤੁਹਾਨੂੰ ਇੱਕ ਚੀਜ਼ ਦਿੱਤਾ ਆਪਦਾ ਪ੍ਰੋਡਕਟ ਵੇਚਣ ਨੂੰ ਤਾਂ ਤੁਹਾਨੂੰ ਉਹਦੇ ਵੇ ਦੇ ਵਿੱਚ ਮਿਲਾਵਟ ਨਹੀਂ ਕਰਨੀ ਚਾਹੀਦੀ ਤੁਹਾਨੂੰ ਪਤਾ ਹੈ ਮੇਰੇ ਸਾਰੇ ਬਾਲ ਖਰਾਬ ਹੋ ਗਏ ਹਨ ਸਾਰੇ ਮੇਰੇ ਬਾਲ ਚਿੱਪ ਚਿੱਪ ਚਿੱਪ ਚਿੱਪ ਕਰ ਰਹੇ ਹਨ ਮੇਰੇ ਸਾਰੇ ਬਾਲ ਝੜ ਗਏ ਹਨ ਠੀਕ ਹੈ ਸਰ ਤੁਹਾਡਾ ਤਾਂ ਇਹਦੇ ਵਿੱਚ ਨਹੀਂ ਕੁਛ ਗਿਆ ਠੀਕ ਹੈ ਤੁਸੀਂ ਤਾਂ ਆਪਦੇ ਬਥੇਰੇ ਪ੍ਰੋਡਕਟ ਬਣਾ ਲੋਂਗੇ ਬਹੁਤ ਪੈਸਾ ਕਮਾ ਲੋਂਗੇ ਪਰ ਮੇਰੇ ਬਾਲਾਂ ਦਾ ਕੀ ਮੇਰੇ ਬਾਲ ਐਡੇ ਸੋਹਣੇ ਹੁੰਦੇ ਸੀਗੇ ਤੁਸੀਂ ਤਾਂ ਸਾਰੇ ਖਰਾਬ ਕਰਤੇ ਸਿਰਫ ਇੱਕ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਮੈਂ ਤੁਹਾਡੀ ਕੰਪਲੇਂਟ ਕਰਾਂਗੀ ਤੁਹਾਡੀ ਦੁਕਾਨ ਬੰਦ ਕਰ ਦਾਂਗੇ ਕਰਵਾ ਦੇਵਾਂਗੇ ਅਤੇ ਹੋਰਾਂ ਨੂੰ ਵੀ ਇਹੀ ਕਹਾਂਗੀ ਕਿ ਤੁਹਾਡੇ ਤੋਂ ਕੋਈ ਪ੍ਰੋਡਕਟ ਨਾ ਖਰੀਦਣ ਮੈਨੂੰ ਕੀ ਪਤਾ ਸੀ ਤੁਸੀਂ ਇੱਦਾਂ ਕਰਦੇ ਹੋ ਮੈਂ ਤਾਂ ਇੱਕ ਬਹੁਤ ਵਧੀਆ ਆਸ ਲੈ ਕੇ ਆਈ ਸੀ ਕਿ ਸ਼੍ਰੀ ਕ੍ਰਿਸ਼ਨਾ ਦੁਕਾਨ ਦਾ ਨਾਮ ਚੱਲਦਾ ਹੈ ਪਰ ਤੁਸੀਂ ਤਾਂ ਸਰ ਮੇਰੇ ਨਾਲ ਠੱਗੀ ਕੀਤੀ ਚਲੋ ਇਹ ਤਾਂ ਇੱਕ ਕੰਡੀਸ਼ਨਰ ਸੀਗਾ ਪਤਾ ਨਹੀਂ ਤੁਸੀਂ ਹੋਰਾਂ ਨਾਲ ਕੀ ਕੁਛ ਕਰਦੇ ਹੋਉਂਗੇ ਕੀ ਕੁਛ ਵੇਚਦੇ ਹੋਉਂਗੇ ਉਹਨਾਂ ਨੂੰ ਮਿਲਾਵਟੀ ਸਮਾਨ ਸਰ ਇੱਦਾਂ ਨਹੀਂ ਕਰਨਾ ਚਾਹੀਦਾ ਹੈਗਾ ਠੀਕ ਹੈ ਮੈਂ ਤੁਹਾਡੇ ਪ੍ਰਡ ਉਸ ਕੰਡੀਸ਼ਨਰ ਨੂੰ ਸਾਂਭ ਕੇ ਰੱਖਿਆ ਹੋਇਆ ਅਤੇ ਮੈਂ ਉਸਨੂੰ ਦਿਖਾਵਾਂਗੀ ਕੋਰਟ ਦੇ ਵਿੱਚ ਪੇਸ਼ ਕਰਾਂਗੀ ਵੀ ਦੇਖੋ ਕਿ ਇਹਨਾਂ ਨੇ ਮੈਨੂੰ ਕਿਵੇਂ ਇਹ ਮਿਲਾਵਟ ਵਾਲਾ ਵੇਚਿਆ ਹੈ ਅਤੇ ਮੇਰੇ ਸਾਰੇ ਬਾਲਾਂ ਦੇ ਵਿੱਚ ਐਲਰਜੀ ਹੋ ਗਈ ਹੈ ਮੇਰੇ ਸਾਰਾ ਬਾਲ ਸਿਰ ਲਾਲ ਲਾਲ ਹੋ ਗਿਆ ਹੈ ਸਿਰ ਦੇ ਵਿੱਚ ਖਾਰਿਸ਼ ਜ਼ਿੰਨੀ ਜ਼ਿਆਦਾ ਹੁੰਦੀ ਹੈ ਜਿਸਦਾ ਕੋਈ ਹਿਸਾਬ ਨਹੀਂ ਹੈ ਉੱਪਰੋਂ ਦੀ ਮੇਰੇ ਦਵਾਈਆਂ 'ਤੇ ਇੰਨੇ ਪੈਸੇ ਲੱਗ ਰਹੇ ਹੈ ਸਰ ਮੈਨੂੰ ਤੁਹਾਡੇ ਤੋਂ ਇਹ ਉਮੀਦ ਬਿਲਕੁਲ ਵੀ ਨਹੀਂ ਸੀਗੀ ਮੈਂ ਤੁਹਾਡੀ ਕੰਪਲੇਂਟ ਕਰਾਂਗੀ ਮੈਂ ਕੱਲ੍ਹ ਹੀ ਤੁਹਾਡੇ ਅਗੇਂਸਟ ਕੇਸ ਫਾਈਲ ਕਰ ਰਹੀ ਹਾਂ